ਸਸਰੀਆ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਪੰਜਾਬ ਸਾਇੰਸ ਤੋਂ ਰਿਪੋਰਟ ਕਰ ਰਿਹਾ ਹਾਂ ਕੀ ਤੁਸੀਂ ਮੈਨੂੰ ਪੰਜਾਬ ਤੋਂ ਗੁਜਰਨ ਵਾਲੇ ਨਦੀਆਂ ਦੇ ਰੂਟ ਬਾਰੇ ਦੱਸ ਸਕਦੇ ਹੋ ਅਤੇ ਸਰ ਤੁਸੀਂ ਮੈਨੂੰ ਸਤਲੁਜ ਨਦੀ ਦਾ ਰੂਟ ਦੱਸ ਸਕਦੇ ਹੋ ਠੀਕ ਹੈ ਸਰ ਅਤੇ ਤੁਸੀਂ ਹੁਣ ਮੈਨੂੰ ਰਵੀ ਨਦੀ ਦਾ ਨੂ ਰੂਟ ਦੱਸ ਸਕਦੇ ਹੋ ਠੀਕ ਹੈ ਸਰ ਅਤੇ ਸਰ ਹੁਣ ਤੁਸੀਂ ਮੈਨੂੰ ਬਿਆਸ ਨਦੀ ਦਾ ਰੂਟ ਦੱਸ ਸਕਦੇ ਹੋ ਠੀਕ ਹੈ ਸਰ ਜੀ ਅਤੇ ਹੁਣ ਤੁਸੀਂ ਮੈਨੂੰ ਘੱਗਰ ਨਦੀ ਦਾ ਰੂਟ ਦੱਸ ਸਕਦੇ ਹੋ ਠੀਕ ਹੈ ਸਰ ਜੀ ਅਤੇ ਹੁਣ ਤੁਸੀਂ ਮੈਨੂੰ ਜੇਹਲਮ ਨਦੀ ਦਾ ਰੂਟ ਦੱਸ ਦਿਓ ਬਸ ਧੰਨਵਾਦ ਸਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਰ ਹਾਂਜੀ ਸਰ ਅਸੀਂ ਨਾ ਇਹ ਰਾਵੀ ਇਹ ਸਾਰੀ ਨਦੀਆਂ ਦੇ ਰੂਟ ਬਾਰੇ ਇੱਕ ਪ੍ਰੋਜੈਕਟ ਤਿਆਰ ਕਰ ਰਹੇ ਸੀ ਜਿਹੜਾ ਕੀ ਕਿ ਹੋਰ ਚੈਨਲਾਂ 'ਤੇ ਦੱਸਣਾ ਸੀ ਲੋਕਾਂ ਨੂੰ ਤਾਂ ਹੀ ਅਸੀਂ ਤੁਹਾਨੂੰ ਫੋਨ ਲਾਇਆ ਸੀ ਜੀ ਨਹੀਂ ਸਰ ਅਸੀਂ ਤੁਹਾਡੇ ਕੋਲੋਂ ਜਿਹੜਾ ਡਾਟਾ ਲਿਆ ਨਾ ਉਹਦੇ ਤੋਂ ਅਸੀਂ ਇੱਕ ਪ੍ਰੋਜੈਕਟ ਬਣਾਵਾਂਗੇ ਅਤੇ ਉਹ ਅਸੀਂ ਆਪਣੀ ਚੈਨਲ 'ਤੇ ਚਲਾਵਾਂਗੇ ਜੀ ਹਾਂਜੀ ਸਰ ਹਾਂਜੀ ਸਰ ਤੁਸੀਂ ਸਾਰੇ ਪੰਜਾਬ ਟਾਈਮਸ 'ਤੇ ਚੈਨਲ ਆਉਂਦਾ ਹੈ ਜੀ ਸਾਡਾ ਉਹਦੇ ਤੋਂ ਤੁਸੀਂ ਵੇਖ ਸਕਦੇ ਹੋ ਸਾਡਾ ਪ੍ਰੋਜੈਕਟ ਜਦੋਂ ਆਵੇਗਾ ਅਸੀਂ ਤੁਹਾਨੂੰ ਤਾਂ ਟਾਈਮ ਵਗੈਰਾ ਦੱਸ ਦਿਆਂਗੇ ਤੁਸੀਂ ਵੇਖ ਸਕਦੇ ਹੋ ਜੀ ਸਾਡਾ ਤੁਹਾਡੇ ਡਾਟਾ 'ਤੇ ਜਿਹੜਾ ਪ੍ਰੋਜੈਕਟ ਤਿਆਰ ਕੀਤਾ ਹੋਇਆ ਠੀਕ ਹੈ ਸਰ ਜੀ ਤੁਹਾਡੀ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਸੀਂ ਆਪਣੇ ਪ੍ਰੋਜੈਕਟ 'ਚ ਚੰਗੀ ਤਰ੍ਹਾਂ ਕੰਮ ਕਰਾਂਗੇ ਅਤੇ ਸਾਰੀ ਗੱਲ ਉਹਨਾਂ ਵੱਲ ਪਹੁੰਚਾਈ ਜਾਵੇਗੀ ਧੰਨਵਾਦ ਜੀ